ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਤੁਸੀਂ ਵਨ ਏ ਸੋਸਾਇਟੀ ਤੋਂ ਬੋਲ ਰਹੇ ਹੋ ਜੀ ਓਕੇ ਮੇਰਾ ਨਾਮ ਪਰਵਿੰਦਰ ਹੈ ਮੈਂ ਮੋਹਾਲੀ ਤੋਂ ਹੀ ਬੋਲ ਰਹੀ ਹਾਂ ਕੀ ਤੁਸੀਂ ਪਹਿਲਾਂ ਤਾਂ ਮੈਂ ਕੀ ਤੁਹਾਡਾ ਨਾਮ ਪੁੱਛ ਸਕਦੀ ਹਾਂ ਜੀ ਕੀ ਆ ਓਕੇ ਹੁਣ ਤੁਸੀਂ ਮੈਨੂੰ ਇੱਕ ਗੱਲ ਦੱਸੋ ਮੈਂ ਵਨ ਰਾਈਜ਼ ਸੋਸਾਇਟੀ ਬਾਰੇ ਕਾਫੀ ਸੁਣਿਆ ਮੈਂ ਇੱਥੇ ਸੋਚ ਰਹੀ ਸੀਗੀ ਵੀ ਮੈਂ ਇੱਥੇ ਰੈਂਟ 'ਤੇ ਜ਼ਾਂ ਪਰਚੇਸ ਕਰਾ ਫਲੈਟ ਕੀ ਮੈਨੂੰ ਤੁਸੀਂ ਥੋੜ੍ਹੀ ਜਿਹੀ ਜਾਣਕਾਰੀ ਦੇ ਸਕਦੇ ਹੋ ਇਸ ਬਾਰੇ ਅੱ ਇੱਕ ਤਾਂ ਮੈਨੂੰ ਇੱਕ ਗੱਲ ਦੱਸੋ ਕਿ ਇੱਥੇ ਪਾਣੀ ਦਾ ਜਿਹੜਾ ਪ੍ਰਬੰਧ ਹੈ ਉਹ ਬਹੁਤ ਵਧੀਆ ਓਕੇ ਅਤੇ ਬਿਜਲੀ ਦੀ ਕੋਈ ਸਮੱਸਿਆ ਤਾਂ ਨਹੀਂ ਓਕੇ ਇਹ ਮੈਂ ਪੁੱਛ ਸਕਦੀ ਹਾਂ ਇਹ ਜਿਹੜੀ ਵਨ ਰਾਈਜ਼ ਸੋਸਾਇਟੀ ਹੈ ਇਹਦੇ ਕਿੰਨੇ ਫਲੋਰ ਨੇ ਓਕੇ ਇੱਥੇ ਵੰਨ ਬੀ ਐੱਚ ਕੇ ਜੇ ਫਰਨਿਸ਼ਡ ਲੈਣਾ ਹੋਵੇ ਅਸੀਂ ਤਾਂ ਉਸ ਦਾ ਕਿੰਨਾ ਕੁ ਰੈਂਟ ਹੋਵੇਗਾ ਓਕੇ ਅਤੇ ਜੇ ਆਪਾਂ ਨੇ ਪਰਚੇਸ ਕਰਨਾ ਹੋਵੇ ਫਿਰ ਕੀ ਰੇਟ ਹੈ ਇਸ ਦਾ ਓਕੇ ਕੀ ਫਲੋਰ ਵਾਈਜ਼ ਜੇ ਉੱਪਰ ਨੂੰ ਜਾਈਏ ਆਪਾਂ ਤਾਂ ਰੇਟ ਘੱਟ ਵੀ ਹੈ ਜ਼ਾਂ ਸੇਮ ਹੀ ਆ ਓਕੇ ਅਤੇ ਇੱਥੇ ਹੋਰ ਕਿਹੜੀਆਂ ਕਿਹੜੀਆਂ ਸਹੂਲਤਾਂ ਨੇ ਕੀ ਜਿੰਮ ਦੀ ਜ਼ਾਂ ਸਵੀਮਿੰਗ ਪੂਲ ਦੀ ਐਵੇਂ ਦੀਆਂ ਸਹੂਲਤਾਂ ਦਿੱਤੀਆਂ ਹੋਈਆਂ ਨੇ ਇਹਨਾਂ ਨੇ ਓਕੇ ਅਤੇ ਇੱਥੇ ਰੂਲ ਰੋਜਾਨਾ ਵਰਤੋਂ ਦੀਆਂ ਚੀਜਾਂ ਦੇ ਲਈ ਕੋਈ ਸ਼ੌਪ ਵੀ ਹੈ ਛੋਟੀ ਮੋਟੀ ਜ਼ਾਂ ਨਹੀਂ ਓਕੇ ਅਤੇ ਪਾਰਕਿੰਗ ਦਾ ਕੀ ਸਿਸਟਮ ਹੈ ਵੈਰੀ ਵੈਰੀ ਗੁੱਡ ਮੈਂ ਸੁਣਿਆ ਤਾਂ ਸੀ ਪਰ ਅੱਜ ਤੁਹਾਡੇ ਤੋਂ ਕਨਫਰਮ ਹੋ ਗਿਆ ਵੀ ਇਹ ਸੁਸਾਇਟੀ ਵਾਕਈ ਅੱਛੀ ਹੈ ਮੈਂ ਜ਼ਰੂਰ ਵਿਜ਼ਿਟ ਕਰੂੰਗੀ ਤੁਹਾਡੀ ਇੰਨੀ ਕੁ ਜਾਣਕਾਰੀ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਮੈਂ ਇੱਕ ਵਾਰੀ ਤੁਹਾਡਾ ਨਾਮ ਪੁੱਛ ਸਕਦੀ ਹਾਂ ਦੁਬਾਰਾ ਓਕੇ ਜੀ ਮੈਂ ਅੱਗੇ ਨੂੰ ਜਸਮੀਤ ਸਿੰਘ ਜੀ ਜਦੋਂ ਵੀ ਮੈਂ ਆਉਣਾ ਹੋਇਆ ਮੈਂ ਤੁਹਾਨੂੰ ਹੀ ਕਾਲ ਕਰੂੰਗੀ ਓਕੇ